ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਯਾਦਵਿੰਦਰਜੀਤ ਸਿੰਘ ਬੋਲਦਾਂ ਜੀ ਠੀਕ ਹੈ ਸਰ ਠੀਕ ਹੈ ਜੀ ਉਰੇ ਆਪਣੇ ਪੰਜਾਬ ਦੇ ਵਿੱਚ ਨਾ ਘੱਟੋ ਘੱਟ ਦਸ ਪੰਦਰ੍ਹਾਂ ਨੇ ਅਸਥਾਨ ਨੇ ਆਪਣਾ ਘੁੰਮਣ ਫਿਰਨ ਵਾਸਤੇ ਇੱਕ ਤਾਂ ਜੀ ਹਰਿਮੰਦਰ ਸਾਹਿਬ ਹੈ ਅਤੇ ਉਹਦੇ ਨਾਲ ਹੈਗਾ ਆਪਣਾ ਜਲ੍ਹਿਆਂਵਾਲਾ ਬਾਗ ਅਤੇ ਇੱਧਰੋਂ ਹੈਗਾ ਜੀ ਆਪਣਾ ਅਨੰਦਪੁਰ ਸਾਹਿਬ ਅਤੇ ਫਿਰ ਜਾਣੀ ਕਿ ਆ ਜੋ ਆਪਣਾ ਮਨ ਬਣਾਓ ਅਤੇ ਤ ਤੁਹਾਡੇ ਨਾਲ ਨਾਲ ਜਿਵੇਂ ਆਪਣਾ ਚੰਨ ਚੰਡੀਗੜ੍ਹ ਹੋ ਗਿਆ ਮੋਹਾਲੀ ਹੋ ਗਿਆ ਹਾਂਜੀ ਅਤੇ ਨਾਭਾ ਅਤੇ ਘੁੰਮਣ ਫਿਰਨ ਵਾਲੇ ਪੰਜਾਬ ਦੇ ਅੰਦਰ ਘੱਟੋ ਘੱਟ ਜੀ ਪੰਦਰ੍ਹਾਂ ਸੋਲ੍ਹਾਂ ਸਥਾਨ ਨੇ ਜੀ ਹਾਂਜੀ ਆਪਣੀ ਕੋਈ ਗੱਲ ਨਹੀਂ ਤੁਸੀਂ ਮਨ ਬਣਾ ਕੇ ਆਜੋ ਆਪਣਾ ਤੁਹਾਨੂੰ ਸੈਰ ਵੀ ਕਰਾ ਆਪਣੇ ਇਕੱਠੇ ਕਰਵਾਵਾਂਗੇ ਸਾਰਾ ਅੱਛਾ ਜੀ ਫਿਰ ਆਪਣਾ ਕਿੱਦਣ ਦਾ ਜੀ ਅੱਛਾ ਅੱਛਾ ਗੁਰਦੀਪ ਸਿੰਘ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਂ ਤੁਹਾਡਾ ਨੰਬਰ ਕਰ ਲੈਣਾ ਜੀ ਸੇਵ ਲਿਖ ਲੈਂਦਾ ਜੀ ਠੀਕ ਹੈ ਠੀਕ ਹੈ ਜੀ ਮੇਰੇ ਨਾਲ ਜ਼ਰੂਰ ਸੰਪਰਕ ਆਪਣਾ ਕਰੀਉ ਠੀਕ ਠੀਕ ਜੀ ਪੰਦਰ੍ਹਾਂ ਵੀਹ ਦਿਨ ਤੱਕ ਅੱਛਾ ਆ ਜਿਓ ਠੀਕ ਹੈ ਜੀ ਹਾਂਜੀ ਹਾਂਜੀ ਆਉਣ ਤੋਂ ਪਹਿਲਾਂ ਨਾ ਮੈਨੂੰ ਇੱਕ ਅੱਛਾ ਇੱਕ ਦੋ ਦਿਨ ਆਪਣਾ ਕਰ ਕਰ ਦਿਓ ਮਾੜਾ ਜਿਹਾ ਪਹਿਲਾਂ ਫੋ ਆਪਣਾ ਵੀ ਫੋਨ ਕਰਦੇ ਇੱਕ ਦੋ ਦਿਨ ਪਹਿਲਾਂ ਆਉਣ ਤੋਂ ਪਹਿਲਾਂ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਜੀ ਓਕੇ ਚਲੋ ਠੀਕ ਹੈ ਜੀ ਚੰਗਾ ਜੀ ਓਕੇ ਜੀ ਧੰਨਵਾਦ ਜੀ